ਖੇਡਾਂ ਵਿੱਚ ਨਕਲੀ ਬੁੱਧੀ ਦੀ ਵਰਤੋਂ ਕਰਨ ਵਾਲੇ ਲੋਕ ਬਹੁਤ ਹੀ ਉਹ ਬੁਰੇ ਹੁੰਦੇ ਹਨ ਉਹਨਾਂ ਬਾਰੇ ਸਾਨੂੰ ਵਧੀਆ ਫੀਲ ਨਹੀਂ ਹੁੰਦਾ ਕਿਉਂਕਿ ਉਹਨਾਂ ਕਰਕੇ ਜਿਹੜੇ ਗਰੀਬ ਘਰ ਦੇ ਬੱਚੇ ਹੈ ਉਹ ਚੰਗੇ ਖੇਲਦੇ ਹੈ ਪਰ ਫਿਰ ਵੀ ਉਹਨਾਂ ਦੀ ਸਿਲੈਕਸ਼ਨ ਨਹੀਂ ਹੋ ਪਾਉਂਦੀ ਹੈ ਇਹਨਾਂ ਕਰਕੇ ਇਹ ਪੈਸੇ ਦੇ ਬਲ 'ਤੇ ਅੱਗੇ ਆ ਜਾਂਦੇ ਹੈ ਪਰ ਇਹਨਾਂ ਨੂੰ ਖੇਲਣਾ ਨਹੀਂ ਆਉਂਦਾ ਹੈ ਜਿਹਨਾਂ ਕਰਕੇ ਗਰੀਬ ਘਰ ਦੇ ਬੱਚੇ ਪਿੱਛੇ ਰਹਿ ਜਾਂਦੇ ਅਤੇ ਇਹ ਅੱਗੇ ਵੱਧ ਜਾਂਦੇ ਅਤੇ ਇਹਨਾਂ ਨੂੰ ਕੁਛ ਖੇਲਣਾ ਉਨਾਂ ਆਉਂਦਾ ਨਹੀਂ ਹੈ ਅਤੇ ਫਿਰ ਗਰੀਬ ਜਿਹੜੇ ਘਰ ਵਾਲੇ ਹੁੰਦੇ ਉਹ ਬਹੁਤ ਨਿਰਾਸ਼ ਹੋ ਜਾਂਦੇ ਜਿਹਨਾਂ ਨੂੰ ਸਭ ਕੁਛ ਵਧੀਆ ਰਹਿੰਦਾ ਹੈ ਅਤੇ ਫਿਰ ਜਿਹੜੇ ਗੇਮ ਹੈ ਉਹਨਾਂ ਵਿੱਚ ਵੀ ਇਹ ਪੈਸੇ ਦੇ ਬਲ 'ਤੇ ਅੱਗੇ ਆ ਜਾਂਦੇ ਅਤੇ ਹਾਰ ਜਾਂਦੇ ਫਿਰ ਦੁੱਖ ਹੁੰਦਾ ਹੈ ਇਸ ਕਰਕੇ ਇਹਨਾਂ ਨੂੰ ਇੱਦਾਂ ਨਹੀਂ ਕਰਨਾ ਚਾਹੀਦਾ ਹੈ ਪੈਸੇ ਦੇ ਬਲ 'ਤੇ ਕਦੇ ਵੀ ਅੱਗੇ ਨਹੀਂ ਵਧਣਾ ਚਾਹੀਦਾ ਹੈ